ਮੇਰੇ ਮਾਤਾ ਪਿਤਾ ਸ਼ਹਿਰ ਤੋਂ ਬਾਹਰ ਇੱਕ ਕਲਾਸਿਕਲ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ ਅਤੇ ਮੈਂ ਉਹਨਾਂ ਨਾਲ ਜਾਣਾ ਚਾਹੁੰਦੀ ਹਾਂ ਮੈਂ ਉਹਨਾਂ ਲਈ ਉਸ ਸ਼ੋਅ ਦੀਆਂ ਟਿਕਟਾਂ ਬੁੱਕ ਕਰ ਦਿੱਤੀਆਂ ਹਨ ਮੇਰੇ ਮਾਤਾ ਪਿਤਾ ਨੂੰ ਕਲਾਸਿਕਲ ਸੰਗੀਤ ਸੁਣਨਾ ਬਹੁਤ ਵਧੀਆ ਲੱਗਦਾ ਹੈ ਇਸ ਦੇ ਵਿੱਚ ਮੈਂ ਉਹਨਾਂ ਦੇ ਲਈ ਇੱਕ ਟਿਕਟ ਬੁੱਕ ਕੀਤੀ ਸੀ ਜਿੱਥੇ ਮੇਰੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਮਿਲੀ ਅਤੇ ਮੈਨੂੰ ਉਹਨਾਂ ਨਾਲ ਸਮਾਂ ਬਿਤਾ ਕੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਮਿਲੀ ਇਸ ਅਨੁਭਵ ਵਿੱਚ ਮੈਂ ਆਪਣੇ ਮਾਤਾ ਪਿਤਾ ਨਾਲ ਕਲਾਸਿਕਲ ਸੰਗੀਤ ਸੁਣਿਆ ਜੋ ਕਿ ਸੁਣਨ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਮਨ ਨੂੰ ਸਕੂਨ ਦੇਣ ਵਾਲਾ ਸੀ ਅਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਮੈਨੂੰ ਉਸ ਸਮੇਂ ਵਿੱਚ ਹੋਈ ਜਦੋਂ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਬੈਠ ਕੇ ਕਲਾਸਿਕਲ ਸੰਗੀਤ ਸੁਣਿਆ